ਗੱਲ ਕਰ ਲੀਏ ਖੇਡ ਸਿਖਲਾਈ ਕੇਂਦਰ ਦੀ ਜਿਵੇਂ ਕਿ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਇੱਕ ਗ੍ਰਾਂ ਖੇਡ ਗ੍ਰਾਊਂਡ ਪਾਇਆ ਜਾਂਦਾ ਹੈ ਜਿਸ ਵਿੱਚ ਕਿ ਅਲੱਗ ਅਲੱਗ ਖੇਲਾਂ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਕਿ ਕ੍ਰਿਕਟ ਵਾਲੀਬੋਲ ਫੁੱਟਬਾਲ ਜਿਸ ਵਿੱਚ ਕਿ ਖਿਡਾਰੀ ਆਪਣੀ ਖੇਡ ਨੂੰ ਅੱਗੇ ਹੋਰ ਵਧਾਵਾ ਦੇ ਸਕਦੇ ਨੇ ਅਤੇ ਸਾਡੇ ਇੱਥੇ ਇੱਕ ਨਹਿਰੂ ਸਟੇਡੀਅਮ ਵੀ ਉਪਲੱਬਧ ਹੈ ਜਿਸ ਵਿੱਚ ਕਿ ਅਲੱਗ ਅਲੱਗ ਖੇਲਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ ਇਸਦੀ ਮਦਦ ਨਾਲ਼ ਅਸੀਂ ਖਿਲਾੜੀ ਬਹੁਤ ਹੀ ਅੱਗੇ ਵੱਧ ਸਕਦੇ ਨੇ ਕਿ ਇਹ ਗੱਲ ਕਰ ਲਈਏ ਅੱਜ ਦੇ ਸਮੇਂ ਵਿੱਚ ਲੋੜ ਵੀ ਹੈ ਕਿ ਵੱਧ ਤੋਂ ਵੱਧ ਸਿਖਲਾਈ ਕੇਂਦਰ ਹੋਰ ਖੋਲ੍ਹੇ ਜਾਣ ਕਿ ਜਿਸ ਨਾਲ਼ ਕਿ ਆਪਣਾ ਖਿਡਾਰੀ ਆਪਣੇ ਖੇਡ ਵਿੱਚ ਅੱਗੇ ਵੱਧ ਸਕਦੇ ਨੇ ਕਿਉਂਕਿ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਇਸ ਵਿੱਚ ਆਪਾਂ ਇਸਨੂੰ ਵਧਾਵਾ ਦੇਣ ਲਈ ਇਸ ਵਿੱਚ ਯੋਗਦਾਨ ਪਾਈਏ ਕਿ ਅੱਜ ਕੱਲ੍ਹ ਬਹੁਤ ਹੀ ਤਕਨੀਕੀ ਯੁੱਗ ਹੋਣ ਦੇ ਕਾਰਨ ਬੱਚੇ ਖੇਡਾਂ ਤੋਂ ਦੂਰ ਜਾ ਰਹੇ ਨੇ ਕਿ ਅਗਰ ਹਰ ਇੱਕ ਪਿੰਡ ਵਿੱਚ ਇੱਕ ਸਿਖਲਾਈ ਕੇਂਦਰ ਜਾਂ ਇੱਕ ਕਿਸੇ ਸ਼ਹਿਰ ਵਿੱਚ ਇੱਕ ਤੋਂ ਵੱਧ ਸਿਖਲਾਈ ਕੇਂਦਰ ਹੋਵੇਗਾ ਤਾਂ ਬੱਚੇ ਵੱਧ ਤੋਂ ਵੱਧ ਉੱਥੇ ਜਾ ਕੇ ਆਪਣੀ ਖੇਡ ਨੂੰ ਪ੍ਰਫੁੱਲਿਤ ਕਰ ਸਕਦੇ ਨੇ ਜੋ ਕਿ ਸਰਕਾ ਅੱਜ ਕੱਲ੍ਹ ਚਾਹੀਦਾ ਹੈ ਕਿ ਬੱਚੇ ਵੱਧ ਤੋਂ ਵੱਧ ਆਪਣੀ ਅਲੱਗ ਅਲੱਗ ਖੇਲਾਂ ਵਿੱਚ ਪਾਰਟੀਸਪੇਟ ਕਰਨ ਹਿੱਸਾ ਲੈਣ ਕਿ ਜਿਸ ਨਾਲ ਕਿ ਉਹਨਾਂ ਦੀ ਸਿਹਤ 'ਤੇ ਵੀ ਚੰਗਾ ਅਸਰ ਪਵੇ ਅਤੇ ਆਪਾਂ ਇੱਕ ਚੰਗੇ ਸਮਾਜ ਨੂੰ ਸਿਰਜਣਾ ਕਰ ਸਕੀਏ